ਹੈਲੋ ਮੈਮ ਆਪ ਐਨ ਜੀ ਓ ਸੇ ਬਾਤ ਕਰ ਰਹੇ ਹੈ ਹਾਂਜੀ ਮੈਮ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਵਿਲੈਜ ਦੀ ਰਹਿਣ ਵਾਲੀ ਹਾਂ ਅਤੇ ਮੈਮ ਵੂਮੇਨਸ ਵਾਸਤੇ ਬਹੁਤ ਸਾਰੀ ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ ਨੇ ਅਤੇ ਪਲੀਜ ਤੁਸੀਂ ਉਹਨਾਂ ਨੂੰ ਦੇਖੋਗੇ ਮੈਮ ਜਿਵੇਂ ਕਿ ਵੂਮੇਨਸ ਲਈ ਪ੍ਰੋਬਲਮ ਆ ਰਹੀਆਂ ਨੇ ਅਤੇ ਪਲੀਜ਼ ਤੁਸੀਂ ਦੇਖੋਗੇ ਕਿ ਵੂਮੈਨਸ ਕਿਵੇਂ ਮਤਲਬ ਕਰ ਸਕਦੇ ਨੇ ਕੰਮ ਵਗੈਰਾ ਹਾਂਜੀ ਹਾਂਜੀ ਮੈਮ ਤੁਸੀਂ ਬਿਲਕੁਲ ਠੀਕ ਕਿਹਾ ਤੁਸੀਂ ਬਿਲਕੁਲ ਠੀਕ ਕਿਹਾ ਜਿਵੇਂ ਕਿ ਰਿਲੀਜਨ ਜਸਟ ਹੁੰਦਾ ਹੀ ਹੈ ਕਿ ਮਤਲਬ ਵੂਮੈਨਸ ਨੂੰ ਇੰਨਾ ਨਹੀਂ ਕੀਤਾ ਜਾਂਦਾ ਸਪੋਰਟ ਅਤੇ ਹਾਂਜੀ ਉਸ ਲਈ ਥੋੜ੍ਹੀ ਪ੍ਰੋਬਲਮਸ ਹੈ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਹਰ ਹਰ ਇੱਕ ਫੀਲਡ ਵਿੱਚ ਵੁਮਨਸ ਨੂੰ ਬਿਲਕੁਲ ਅੱਗੇ ਹੈਗੀਆਂ ਨੇ ਅਤੇ ਵਿਲੇਜ ਵਿੱਚ ਹਾਲੇ ਇੰਨਾ ਨਹੀਂ ਹੈਗਾ ਅਤੇ ਪਲੀਜ਼ ਤੁਸੀਂ ਹਾਂਜੀ ਅਤੇ ਤੁਸੀਂ ਪਲੀਜ਼ ਹੈਲਪ ਕਰੋਗੇ ਪਲੀਜ਼ ਥੋੜ੍ਹਾ ਆ ਕੇ ਗਾਈਡ ਕਰ ਸਕਦੇ ਹੋ ਮੇਰਾ ਨਾਮ ਕਸ਼ਿਸ਼ ਹੈ ਅਤੇ ਇੱਥੇ ਫਾਜ਼ਲਿਕਾ ਵਿੱਚ ਇੱਕ ਪਿੰਡ ਹੈਗਾ ਸੁਰੇਸ਼ ਵਾਲਾ ਬਾਰਡਰ ਰੋਡ ਵਾਲੀ ਸਾਈਡ ਪੈਂਦਾ ਅਤੇ ਉੱਥੇ ਉੱਥੇ ਮੈਂ ਰਹਿੰਦੀ ਹਾਂ ਅਤੇ ਉੱਥੇ ਕਾਫੀ ਸਾਰੀ ਪ੍ਰੋਬਲਮਸ ਹੈਗੀਆਂ ਨੇ ਮੈਂ ਦੇਖਿਆ ਕਿ ਵੁਮੈਨਸ ਨੂੰ ਇੰਨਾ ਸਪੋਰਟ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਨੂੰ ਸਿਰਫ ਘਰ ਜੋਗਾ ਹੀ ਰੱਖਿਆ ਜਾਂਦਾ ਮਤਲਬ ਜਿਵੇਂ ਕਿ ਬਾਹਰ ਵੀ ਕੰਮ ਨਹੀਂ ਕਰਨ ਦਿੰਦੇ ਸਿਰਫ ਘਰ ਹੀ ਕੰਮ ਕਰਨਾ ਤਾਂ ਕਈ ਪ੍ਰੋਬਲਮਸ ਹੈ ਹਾਂਜੀ ਮੈਮ ਬਿਲਕੁਲ ਤੁਸੀਂ ਸਪੋਰਟ ਕਰਿਓ ਥੋੜ੍ਹਾ ਗਾਈਡ ਕਰਿਓ ਪਲੀਜ਼ ਤੁਸੀਂ ਹੈਲਪ ਕਰਿਓ ਅਤੇ ਆਇਓ ਮੈਂ ਤੁਹਾਨੂੰ ਸਭ ਕੁਝ ਡਿਟੇਲ 'ਚ ਮੈਂ ਮੈਸੇਜ ਕਰਕੇ ਤੁਹਾਨੂੰ ਦਸ ਦਾਂਗੀ ਹਾਂਜੀ ਮੈਮ ਤੁਹਾਨੂੰ ਪਤਾ ਹੀ ਹੈ ਕਿ ਗਰਲਜ ਨੂੰ ਵੀ ਥੋੜ੍ਹੀ ਪ੍ਰੋਬਲਮਸ ਆਉਂਦੀਆਂ ਨੇ ਐਜੂਕੇਸ਼ਨ ਵਿੱਚ ਬੈਸਟ ਐਜੂਕੇਸ਼ਨ ਨਹੀਂ ਮਿਲ ਪਾਉਂਦੀ ਜਿਵੇਂ ਕਿ ਵਿਲੇਜ ਵਿੱਚ ਤੁਹਾਨੂੰ ਪਤਾ ਹੀ ਹੈ ਅਤੇ ਉਹਨਾਂ ਨੂੰ ਮਤਲਬ ਸਿਟੀ ਵਿੱਚ ਸਟਡੀ ਕਰਨ ਲਈ ਨਹੀਂ ਭੇਜਦੇ ਪੈਰੈਂਟਸ ਥੋੜ੍ਹਾ ਹਾਂਜੀ ਹਾਂਜੀ ਮੈਮ ਹਾਂਜੀ ਮੈਨੂੰ ਵੀ ਤੁਹਾਡਾ ਕਿਸੇ ਨੇ ਨੰਬਰ ਦਿੱਤਾ ਸੀ ਤਾਂ ਉਹ ਕਹਿੰਦੇ ਕਿ ਤੁਸੀਂ ਇਹਨਾਂ ਕੋਲ ਜਾਓ ਇਹ ਪੂਰੀ ਤੁਹਾਡੀ ਹੈਲਪ ਕਰਨਗੇ ਤਾਂ ਹੀ ਮੈਂ ਤੁਹਾਨੂੰ ਕਾਲ ਕਰਕੇ ਸਾਰੀ ਆਪਣੀ ਪ੍ਰੋਬਲਮ ਦੱਸੀ ਵਿਲੇਜ ਦੀ ਅਤੇ ਹਾਂਜੀ ਓਕੇ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਮੈਂ ਤੁਹਾਨੂੰ ਸਾਰੀ ਡਿਟੇਲ ਸੈਂਡ ਕਰ ਦਾਂਗੀ ਅਤੇ ਤੁਸੀਂ ਜਦੋਂ ਵੀ ਆਉਣਾ ਹੋਵੇ ਤੁਸੀਂ ਮੈਨੂੰ ਕਾਲ ਕਰ ਦਿਓ ਬਿਲਕੁਲ ਤੁਸੀਂ ਕਿਹਾ ਸੀ ਸਾਡੀ ਯੂਨਿਟੀ ਹੈਗੀ ਹੈ ਵ ਸਾਰੀ ਕੁਛ ਵੁਮੈਨ ਦੀਆਂ ਅਤੇ ਹਾਂਜੀ ਅਤੇ ਅਸੀਂ ਤੁਹਾਨੂੰ ਮਿਲ ਲਵਾਂਗੇ ਅਤੇ ਤੁਸੀਂ ਪਲੀਜ ਗੱਲ ਕਰਿਓ ਓ ਓਕੇ ਮੈਮ ਓਕੇ ਮੈਮ ਥੈਂਕ ਯੂ ਸੌ ਮਚ ਓਕੇ ਮੈਮ ਬਾਏ